ਹੈਲੋ ਹਾਂ ਪੁਰੂ ਕੀ ਹਾਲ ਏ ਵਧੀਆ ਬਸ ਸਭ ਵਧੀਆ ਤੂੰ ਸੁਣਾ ਪਾਪਾ ਮਮਾ ਵਧੀਆ ਹਾਂ ਇੱਕ ਮੈਂ ਚੀਜ਼ ਪੁੱਛਣੀ ਸੀ ਤੇਰੇ ਤੋਂ ਮੈਂ ਨਾ ਪੈਨ ਕਾਰਡ ਬਣਵਾਉਣਾ ਸੀ ਕਿਉਂ ਉਹ ਆਈ ਟੀ ਆਰ ਭਰਨੀ ਸੀ ਹਾਂ ਹਾਂ ਟੈਕਸੇਬਲ ਹੋ ਗਈ ਇਨਕਮ ਹਾਂ ਅਤੇ ਮੈਨੂੰ ਦੱਸਿਆ ਕਿਸੇ ਨੇ ਕਿ ਤੂੰ ਤੈਨੂੰ ਪਤਾ ਸਾਰਾ ਪ੍ਰੋਸੀਜਰ ਹਾਂ ਅਤੇ ਕਰੀ ਦੱਸੀ ਸਾਰਾ ਕੀ ਕੀ ਕਿਹੜਾ ਕਿਹੜਾ ਡਾਕੂਮੈਂਟ ਚਾਹੀਦਾ ਕਿੰਨੀਆਂ ਫੋਟੋਆਂ ਕਿਹਦੇ ਕਿਹਦੇ ਸਾਈਨ ਕਿੱਥੋਂ ਕਿੱਥੋਂ ਅਤੇ ਕਿੱਥੋਂ ਅਪਲਾਈ ਕਰਨਾ ਅਤੇ ਅਗਰ ਵੀ ਦੁਕਾਨ ਪਤਾ ਦੁਕਾਨ ਦੱਸ ਦਿਓ ਉੱਥੇ ਜਾ ਕੇ ਅਗਰ ਸੌਖਾ ਹੋ ਜੇ ਤਾਂ ਠੀਕ ਹੈ ਹਾਂ ਚਲ ਇਕ ਆਧਾਰ ਕਾਰਡ ਇੱਕ ਬਰਥ ਸਰਟੀਫਿਕੇਟ ਅੱਛਾ ਅਤੇ ਇੱਕ ਸਭ ਤੋਂ ਰੀਸੈਂਟ ਜਿਹੜਾ ਵੀ ਕੋਈ ਪਾਸ ਕੀਤਾ ਸਕੂਲ ਜਾਂ ਯੂਨੀਵਰਸਿਟੀ ਉਹਨਦਾ ਸਰਟੀਫਿਕੇਟ ਠੀਕ ਹੈ ਅਤੇ ਫੋਟੋਆਂ ਕਿੰਨੀਆਂ ਚਾਹੀਦੀਆਂ ਤਿੰਨ ਠੀਕ ਹੈ ਅਤੇ ਫੋਰਮ ਕਿੱਥੋਂ ਮਿਲੇਗਾ ਇਹਦਾ ਆਨਲਾਈਨ ਫੋਰਮ ਫਿਲ ਹੋ ਜਾਏਗਾ ਜਾਂ ਬਾਜ਼ਾਰੋਂ ਕਿਸੇ ਵੀ ਦੁਕਾਨ ਤੋਂ ਮਿਲ ਜਾਏਗਾ ਅੱਛਾ ਠੀਕ ਹੈ ਅਤੇ ਵੈਬਸਾਈਟ 'ਤੇ ਅਪਲਾਈ ਕਰਨਾ ਠੀਕ ਹੈ ਕਦੋਂ ਤੱਕ ਆ ਜਾਂਦੇ ਅਪਲਾਈ ਹੋਣ ਤੋਂ ਬਾਅਦ ਅੱਛਾ ਦੋ ਕੁ ਹਫਤੇ ਲੱਗਦੇ ਆ ਠੀਕ ਹੈ ਚਲ ਮੈਂ ਅਪਲਾਈ ਕਰਕੇ ਵੇਖਣਾ ਅਗਰ ਕੋਈ ਦਿੱਕਤ ਆਈ ਤਾਂ ਤੈਨੂੰ ਫਿਰ ਤੋਂ ਫੋਨ ਕਰਾਂਗਾ ਓਕੇ ਬਾਏ